ਹੈਲੋ ਹਾਂਜੀ ਕੌਣ ਜੀ ਹਾਂਜੀ ਹਾਂਜੀ ਫਰਨੀਚਰ ਵਾਲੀ ਦੁਕਾਨ ਤੋਂ ਬੋਲਦੇ ਆਂ ਜੀ ਹਾਂਜੀ ਦੱਸੋ ਜੀ ਅੱਛਾ ਬੈੱਡ ਅਰ ਸੋਫਾ ਠੀਕ ਐ ਜੀ ਦੇਖੋ ਜੀ ਇਹ ਤਾਂ ਪੁਰਾਣੇ ਸਮਾਨ ਤੇ ਡਿਪੈਂਡ ਕਰਦਾ ਥੋਡਾ ਕਿੰਨਾ ਕ ਪੁਰਾਣਾ ਐ ਅੱਛਾ ਵਧੀਆ ਕੰਡੀਸ਼ਨ 'ਚ ਪਿਆ ਐ

ਉਹ ਤਾਂ ਸਰ ਹੋਏਗਾ ਕੋਈ ਨੀ ਪਤਾ ਗੱਲ ਕੀ ਐ ਕੀ ਅਸੀਂ ਕਰ ਲੈਨੇ ਆਂ ਸਮਾਨ ਦੇ ਉੱਤੇ ਹੀ ਢੁੱਕਦਾ ਐ ਜਿਵੇਂ ਕਈ ਵਾਰੀ ਤਾਂ ਫਿਫਟੀ ਫਿਫਟੀ ਪਰਸੈਂਟ ਮਤਲਬ ਹੋ ਜਾਂਦਾ ਐ ਜਿਵੇਂ ਤੁਸੀਂ ਸਾਨੂੰ ਸਮਾਨ ਦਿਓਗੇ ਤਾਂ ਜਿਹੜਾ ਸਮਾਨ ਅਸੀਂ ਤੁਹਾਨੂੰ ਨਵਾਂ ਵਾਲਾ ਦੇਵਾਂਗੇ ਉਹਦੇ ਚ ਜੇਕਰ ਉਹਦੀ ਕੰਡੀਸ਼ਨ ਬਹੁਤ ਅੱਛੀ ਪਈ ਐ ਫੇਰ ਤਾਂ ਅਸੀਂ ਹਾਫ ਰੇਟ ਤੇ ਕਰ ਲੈਨੇ ਆਂ ਜੇ ਜੇਕਰ ਮਤਲਬ ਥੋੜਾ ਜਿਆ ਉਹਦੇ ਵਿੱਚ ਕੋਈ ਰਿਪੇਰਿੰਗ ਦੀ ਜਰੂਰਤ ਐ ਥੁਆਡੇ ਵਾਲੇ ਸਮਾਨ ਦੇ ਵਿੱਚ ਕੋਈ ਮਤਲਬ ਸਰਮਾਇਕਾ ਵਗੈਰਾ ਉੱਤਰਿਆ ਜਾਂ ਕੋਈ ਕਲਰ ਹੋਣ ਆਲਾ ਜਾਂ ਕੁਛ ਵੀ ਆ ਤਾਂ ਉਹਦੀ ਕੀਮਤ ਫੇਰ ਸੱਠ ਚਾਲੀ ਪੈ ਜਾਏਗੀ ਮਤਲਬ ਚਾਲੀ ਪਰਸੈਂਟ ਥੁਆਨੂੰ ਕੀਮਤ ਸੱਠ ਤੁਸੀਂ ਸਾਨੂੰ ਦਿਓਂਗੇ ਨਵੇਂ ਵਾਲੇ ਦੀ ਤਾਂ ਇਸ ਤਰੀਕੇ ਨਾਲ ਹੋ ਜਾਏਗਾ ਜੀ ਪੋਲਸੀਆਂ ਹੈਗੀਆਂ ਜੇਕਰ ਓਸਤੋਂ ਵੀ ਵਧੀਆ ਪਿਆ ਤਾਂ ਉਹ ਪੈਸੇ ਫਿਫਟੀ ਤੋਂ ਵੀ ਘੱਟ ਜਾਣਗੇ ਥੁਆਡੇ ਹਾਂ ਸਾਡੇ ਕੋਲੇ ਹਰ ਤਰ੍ਹਾਂ ਦੇ ਕਸਟਮਰ ਆਉਂਦੇ ਰਹਿੰਦੇ ਆ ਮਤਲਬ ਕਈ ਵਰੀ ਜਰੂਰੀ ਨੀ ਕਿ ਸਾਰੇ ਕਸਟਮਰ ਨਵਾਂ ਹੀ ਮੰਗਦੇ ਹੋਣ ਕਈਆਂ ਦੀ ਮਤਲਬ ਆਪਦੀ ਫਾਈਨੈਸ਼ੀਅਲੀ ਕੰਡੀਸ਼ਨ ਦੇ ਅਨੁਸਾਰ ਕਈ ਕਹਿ ਦਿੰਦੇ ਜੀ ਸਾਨੂੰ ਪੁਰਾਣਾ ਮਿਲਜੇ ਸਾਡੇ ਕੋਲ ਕਸਟਮਰ ਆਉਂਦੇ ਰਹਿੰਦੇ ਐ ਜੀ ਅਸੀਂ ਜਰੂਰ ਥੁਆਡੇ ਨਾਲ ਜਿਹੜਾ ਕੀ ਕਰਲਾਂਗੇ ਤੇ ਤੇ ਲੱਕੜ ਵਗੈਰਾ ਦੀ ਲੱਕੜ ਵਗੈਰਾ ਦੀ ਕੁਆਲਟੀ ਕੀ ਐ ਮਤਲਬ ਸੈਲ ਵਗੈਰਾ ਲੱਗੀ ਆ ਜਾਂ ਟਾਹਲੀ ਐ ਕਿਸ ਤਰ੍ਹਾਂ ਦੀ ਲੱਕੜ ਲੱਗੀ ਐ ਉਹਨੂੰ ਅੱਛਾ ਸੈਲ ਦਾ ਠੀਕ ਐ ਜੀ ਨਵਾਂ ਤਾਂ ਮਿਲੇਗਾ ਈ ਜੀ ਹਾਂਜੀ ਲੇਟੈਸਟ ਜੀ ਬੈੱਡ ਤਾਂ ਹੈ ਹਾਂਜੀ ਹਾਂਜੀ ਹੈਗਾ ਜੀ ਉਹ ਫੋਲਡ ਹੋ ਜਾਂਦਾ ਐ ਜੇਕਰ ਉਹਨੂੰ ਲੰਬਾ ਖਿੱਚ ਲਈਏ ਤਾਂ ਉਹ ਤਾਂ ਹਾਂਜੀ ਓਸ ਤਰ੍ਹਾਂ ਦੇ ਉਹਦੇ ਚ ਤਿੰਨ ਤਰ੍ਹਾਂ ਨਾਲ ਉਹ ਸਟੈਪ ਪੈਂਦੇ ਐ ਉਹਦੇ ਚ ਹਾਂ ਉਹ ਸੋਫਾ ਬਣ ਜਾਂਦਾ ਐ ਜੇਕਰ ਮਤਲਬ ਆਪਾਂ ਉਹਨੂੰ ਲੰਬਾ ਕਰ ਲਈਏ ਤਾਂ ਤਿੰਨੋਂ ਸਟੈਪ ਵਿੱਚੋਂ ਨਿੱਕਲ ਕੇ ਬੈੱਡ ਵੀ ਬਣ ਜਾਂਦਾ ਐ ਤਾਂ ਇਹਦੇ ਨਾਲ ਦੇਖੋ ਜਗ੍ਹਾ ਦੀ ਵੀ ਵਧੀਆ ਘੱਟ ਜਗ੍ਹਾ ਜਿਹਦੇ ਕੋਲ ਹੈਗੀ ਆ ਤਾਂ ਕਮਰਿਆਂ ਦਾ ਕਮਰਿਆਂ ਦਾ ਏਰੀਆ ਘੱਟ ਐ ਉਹਦੇ ਲਈ ਬਹੁਤ ਵਧੀਆ ਚੀਜ ਐ ਉਹਨੂੰ ਸੋਫਾ ਬਣਾ ਲੋ ਚਾਹੇ ਬੈੱਡ ਬਣਾ ਲੋ ਜਿਵੇਂ ਮਰਜੀ ਕਰ ਲੋ ਓਸ ਤੋਂ ਇਲਾਵਾ ਆਪਣੇ ਕੋਲ ਜਿਹੜਾ ਕੀ ਐ ਦੂਸਰੇ ਬੈੱਡ ਵੀ ਹੈਗੇ ਜਿਹੜੇ ਫੋਲਡ ਨੀ ਹੁੰਦੇ ਅਲੱਗ ਅਲੱਗ ਸਾਈਜ ਦੇ ਹੈਗੇ ਆ ਕਮਰੇ ਦੇ ਸਾਬ ਨਾਲ ਜੇ ਕਮਰਾ ਵੱਡਾ ਤਾਂ ਥੋੜਾ ਵੱਡਾ ਵੀ ਮਿਲਜੂਗਾ ਢੋ ਚ ਫਰਕ ਜਾਂਦਾ ਜੀ ਜਿਹੜਾ ਬੈਕ ਢੋ ਹੁੰਦਾ ਆਪਣਾ ਉਹ ਲੋਂਗ ਵੀ ਮਿ ਲੋਂਗ ਮਿਲ ਜਾਂਦਾ ਛੋਟਾ ਵੀ ਮਿਲ ਜਾਂਦਾ ਐ

ਹਾਂਜੀ ਹਾਂਜੀ ਹਾਂਜੀ ਓਡਰ ਤੇ ਇਹ ਹੁੰਦਾ ਵੀ ਜੇ ਤੁਸੀਂ ਓਡਰ ਤੇ ਬਣਵਾਓਂਗੇ ਤਾਂ ਉਹ ਫੇਰ ਥੋਡੇ ਰੂਮ ਦੇ ਸਾਬ ਨਾਲ ਤਿਆਰ ਕਰ ਦਿਆਂਗੇ ਫੇਰ ਗੱਦਾ ਵਗੈਰਾ ਵੀ ਓਡਰ ਤੇ ਉਸ ਸਾਬ ਨਾਲ ਈ ਤਿਆਰ ਕਰਨਾ ਪਏਗਾ ਇੱਕ ਤਾਂ ਨੌਰਮਲ ਸੈਜ ਗੱਦਾ ਹੁੰਦਾ ਐ ਜਿਹੜਾ ਮੰਨ ਲੋ ਮਾਰਕੀਟ ਚੋਂ ਮਿਲਦਾ ਈ ਐ ਜਿਵੇਂ ਛੇ ਫੁੱਟ ਲੰਬਾਈ ਹੁੰਦੀ ਐ ਤਿੰਨ ਫੁੱਟ ਚੌੜਾਈ ਹੁੰਦੀ ਐ ਇੱਕ ਗੱਦੇ ਦੀ ਤਾਂ ਮਤਲਬ ਉਹ ਛੇ ਫੁੱਟ ਚੌੜਾਈ ਹੋਗੀ ਟੋਟਲ ਬੈੱਡ ਦੀ ਤੇ ਔਰ ਉਹ ਵੀ ਛੇ ਤਿੰਨ ਦਾ ਈ ਹੋਗਿਆ ਦੋ ਗੱਦੇ ਜੁੜ ਜਾਂਦੇ ਐ ਹਾਂ ਉਹ ਤਾਂ ਨੌਰਮਲ ਸਾਈਜ ਚੱਲਦਾ ਈ ਚੱਲਦਾ ਉਹ ਤਾਂ ਸਿੱਧੇ ਈ ਗੱਦੇ ਆਉਂਦੇ ਡਨਲੋਪ ਦਾ ਆਉਂਦਾ ਜਾਂ ਕੋਈ ਵੀ ਆਉਂਦੇ ਐ ਜੇਕਰ ਆਪਾਂ ਮੰਨ ਲੋ ਸਾਈਜ ਤੇ ਕੋਈ ਆਪਦੇ ਕਮਰੇ ਦੇ ਸਾਬ ਦੇ ਨਾਲ ਬੈੱਡ ਬਣਵਾਵਾਂਗੇ ਫੇਰ ਗੱਦਾ ਵੀ ਸਾਨੂੰ ਉਸ ਸਾਬ ਨਾਲ ਤਿਆਰ ਕਰਵਾਉਣਾ ਪੈਂਦਾ ਐ ਤਾਂ ਹਰੇਕ ਚੀਜ ਅਵੇਲੇਬਲ ਐ ਜੀ ਹਾਂਜੀ ਕੋਈ ਗੱਲ ਨੀ ਤੁਸੀਂ ਪਹੁੰਚੋ ਵਿਜਿਟ ਕਰੋ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰਾ ਜੀ ਸਿੰਪਲ ਲੈ ਲੋ ਵਿਦਾਊਟ ਜਿਵੇਂ ਛੋਟਾ ਛੋਟਾ ਢੋ ਹੁੰਦਾ ਇੱਕ ਤਾਂ ਹੈਨਾ ਉਹ ਵੀ ਮਿਲਜੂਗਾ ਚਾਹੇ ਉਹਨੂੰ ਢੋ ਨੂੰ ਤੁਸੀਂ ਛੱਤ ਤੱਕ ਲਵਾ ਲੋ ਕੋਈ ਗੱਲ ਨੀ ਜੀ ਓਨਾਂ ਈ ਲੋਂਗ ਹੋਜੂਗਾ ਵਿੱਚ ਬੱਲਬ ਵਗੈਰਾ ਲੱਗ ਜਾਣਗੇ ਵਧੀਆ ਰੋਸ਼ਨੀ ਵੀ ਸੋਹਣਾ ਲੱਗਦਾ ਕਲਰਫੁੱਲ ਜਿਹੇ ਜਿਹਾ ਮਰਜੀ ਕਲਰ ਕਰਵਾਓ ਕੁਛ ਇੰਸਟੋਲਮੈਂਟ ਹਾਂਜੀ ਜੇ ਥੁਆਡਾ ਠੀਕ ਐ ਮਤਲਬ ਲੈਣ ਦੇਣ ਸਿੰਬਲ ਵਗੈਰਾ ਵਧੀਆ ਐ ਤਾਂ ਇੰਸਟੋਲਮੈਂਟ ਤੇ ਵੀ ਹੋਜੂਗਾ ਸਾਰਾ ਕੰਮ ਕੋਈ ਗੱਲ ਨੀ ਜੀ ਹੋਜੇਗਾ ਕੋਈ ਨੀ ਜੀ ਜਰੂਰ ਆਓ ਹਾਂ ਕੋਈ ਹੋਰ ਵੀ ਚੀਜ ਚਾਈਦੀ ਹੋਵੇ ਮੰਨ ਲੋ ਕੁਰਸੀਆਂ ਕੋਈ ਹੋਰ ਜਾਂ ਕੋਈ ਟੇਬਲ ਟੇਬਲ ਉਹ ਪ੍ਰੈੱਸ ਟੇਬਲ ਜਿਹੜਾ ਹੁੰਦਾ ਐ ਜਾਂ ਸਿੰਪਲ ਟੇਬਲ ਜਾਂ ਕੋਈ ਦੀਵਾਨ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਬੈਂਚ ਮੇਜ ਟੇਬਲ ਸਾਰਾ ਕੁਛ ਅਵੇਲੇਬਲ ਐ ਵੈਸੇ ਥੋਡੀ ਬੈੱਡ ਦੀ ਰਿਕੁਆਇਰਮੈਂਟ ਐ ਨਾ

ਕੋਈ ਗੱਲ ਨੂੰ ਥੋਡਾ ਪੁਰਾਣਾ ਵੀ ਬਦਲ ਦਿਆਂਗੇ ਤੁਸੀਂ ਇੱਕ ਵਾਰੀ ਆਓ ਸ਼ੋਪ ਤੇ ਹਾਂਜੀ ਹਾਂਜੀ ਠੀਕ ਐ ਜੀ ਓਕੇ